ਵੈਸੇ ਤਾਂ ਮੈਨੂੰ ਸਾਰੇ ਪੰਜਾਬੀ ਲੇਖਕ ਪਸੰਦ ਨੇ ਮੈਂ ਸਭ ਦੀ ਇੱਜ਼ਤ ਕਰਦੀ ਹਾਂ ਪਰ ਸੁਰਜੀਤ ਪਾਤਰ ਜੀ ਮੈਨੂੰ ਸਭ ਤੋਂ ਜ਼ਿਆਦਾ ਪਸੰਦ ਨੇ ਮੈਂ ਅਕਸਰ ਹੀ ਉਹਨਾਂ ਦੀਆਂ ਰਚਨਾਵਾਂ ਪੜ੍ਹਦੀ ਅਤੇ ਸੁਣਦੀ ਰਹਿੰਦੀ ਹਾਂ ਮੈਨੂੰ ਬਚਪਨ ਤੋਂ ਹੀ ਲਿਖਣ ਦਾ ਅਤੇ ਵੱਖ ਵੱਖ ਕਿਤਾਬਾਂ ਅਤੇ ਪੰਜਾਬੀ ਰਚਨਾਵਾਂ ਪੜ੍ਹਨ ਦਾ ਸ਼ੌਂਕ ਹੈ ਮੈਂ ਆਪਣੇ ਕਮਰੇ ਵਿੱਚ ਵੀ ਬਹੁਤ ਸਾਰੀਆਂ ਪੰਜਾਬੀ ਸਾਹਿਤ ਦੀਆਂ ਕਿਤਾਬਾਂ ਰੱਖੀਆਂ ਹੋਈਆਂ ਹਨ ਜਿਹਨਾਂ ਵਿੱਚ ਜ਼ਿਆਦਾ ਸੁਰਜੀਤ ਪਾਤਰ ਜੀ ਦੀਆਂ ਰਚਨਾਵਾਂ ਹਨ ਸੁਰਜੀਤ ਪਾਤਰ ਦੀਆਂ ਰਚਨਾਵਾਂ ਵਿੱਚ ਇੱਕ ਇੱਕ ਗੱਲ ਬਹੁਤ ਬਹੁਤ ਵਧੀਆ ਤਰੀਕੇ ਨਾਲ ਲਿਖੀ ਅਤੇ ਦਰਸਾਈ ਗਈ ਹੈ ਮੈਨੂੰ ਉਹਨਾਂ ਦੇ ਲਿਖਣ ਦਾ ਅੰਦਾਜ਼ ਬਹੁਤ ਪਸੰਦ ਹੈ ਉਹਨਾਂ ਦੀ ਹਰੇਕ ਰਚਨਾ ਦਾ ਬਹੁਤ ਡੂੰਘਾ ਅਤੇ ਪ੍ਰਭਾਵਸ਼ਾਲੀ ਅਰਥ ਹੁੰਦਾ ਹੈ ਉਹ ਮਾਂ ਬੋਲੀ ਪੰਜਾਬੀ ਨੂੰ ਬਹੁਤ ਪਿਆਰ ਕਰਦੇ ਆ ਅਤੇ ਸਤਿਕਾਰ ਕਰਦੇ ਆ ਅਤੇ ਮੈਨੂੰ ਵੀ ਆਪਣੀ ਮਾਂ ਬੋਲੀ ਨਾਲ ਬਹੁਤ ਪਿਆਰ ਅਤੇ ਸਤਿਕਾਰ ਹੈ ਮੇਰੀਆਂ ਰਚਨਾਵਾਂ ਨੂੰ ਸੁਰਜੀਤ ਪਾਤਰ ਜੀ ਦੀਆਂ ਰਚਨਾਵਾਂ ਬਹੁਤ ਪ੍ਰਭਾਵਿਤ ਸ਼ਲ ਪ੍ਰਭਾਵਿਤ ਕਰਦੀਆਂ ਹਨ ਮੈਂ ਉਹਨਾਂ ਵਾਂਗ ਤਾਂ ਨਹੀਂ ਲਿਖ ਸਕਦੀ ਪਰ ਹਰੇਕ ਵਾ ਵਾਰ ਇਹੀ ਕੋਸ਼ਿਸ਼ ਹੁੰਦੀ ਹੈ ਅਗਲੀ ਵਾਰ ਹੋਰ ਵੀ ਵਧੀਆ ਢੰਗ ਨਾਲ ਲਿਖਾਂ